ਭਾਰਤ ਵਿੱਚ ਬਹੁਤ ਜ਼ਿਆਦਾ ਬਿਜਨਸਮੈਨ ਹਨ ਜਿਹੜੇ ਭਾਰਤ ਦੀ ਤਰੱਕੀ ਵਾਸਤੇ ਬਹੁਤ ਕੁਝ ਕੰਮ ਕਰ ਰਹੇ ਹਨ ਜਿੱਦਾਂ ਕਿ ਮੁਕੇਸ਼ ਅੰਬਾਨੀ ਜਿਸ ਨੇ ਆਪਣੇ ਇੰਡੀਆ ਵਿੱਚ ਇੰਨੇ ਜ਼ਿਆਦਾ ਬਿਜ਼ਨਸ ਖੋਲ੍ਹ ਦਿੱਤੇ ਹਨ ਕਿ ਹਰ ਇੱਕ ਬਿਜ਼ਨਸ ਭਾਰਤ ਦੀ ਤਰੱਕੀ ਵਿੱਚ ਬਹੁਤ ਜ਼ਿਆਦਾ ਵੱਡਾ ਹੱਥ ਨਿਭਾਅ ਰਹੇ ਹਨ ਜਿੱਦਾਂ ਕਿ ਅੱਜ ਮੁਕੇਸ਼ ਅੰਬਾਨੀ ਨੇ ਇੰਡੀਆ ਵਿੱਚ ਭਾਰਤ ਵਿੱਚ ਜੀਓ ਦੀ ਕੰਪਨੀ ਤੇਲ ਦੀ ਕੰਪਨੀ ਏ ਫਰੂਟ ਦੀ ਕੰਪਨੀ ਅਤੇ ਹੋਰ ਵੀ ਬੜੀ ਜ਼ਿਆਦਾ ਵੱਡੇ ਵੱਡੇ ਬਿਜ਼ਨਸ ਖੋਲ੍ਹ ਚੁੱਕੇ ਹਨ ਜੀਓ ਦਾ ਪੂਰੇ ਭਾਰਤ ਵਿੱਚ ਇੰਨਾਂ ਵੱਡਾ ਸਟੇਕ ਆ ਚੁੱਕਾ ਹੈ ਕਿ ਅੱਜ ਕੋਈ ਵੀ ਹੋਰ ਕੰਪਨੀ ਉਹਦੇ ਨਾਲ ਟੱਕਰ ਲੈਣ ਤੋਂ ਵੀ ਡਰਦੀ ਹਨ ਉਸੀ ਉਸੇ ਤਰ੍ਹਾਂ ਆਇਲ ਵਾਧੇ ਜੀ ਏ ਮੁਕੇਸ਼ ਅੰਬਾਨੀ ਦੀ ਕੰਪਨੀ ਦਾ ਇੰਨਾਂ ਵੱਡਾ ਰੋਲ ਹੈ ਜਿਹਦੇ ਕਾਰਨ ਅੱਜ ਹਰ ਇੱਕ ਸਟੇਟ ਜ਼ਿਆਦਾਤਰ ਮੁਕੇਸ਼ ਅੰਬਾਨੀ ਦੀ ਓਇਲ ਦੀ ਕੰਪਨੀ ਤੋਂ ਹੀ ਤੇਲ ਮੰਗਾਉਂਦੀ ਹਨ ਮੁਕੇਸ਼ ਅੰਬਾਨੀ ਦੇ ਨਾਲ ਨਾਲ ਅ ਅਡਾਨੀ ਵੀ ਹੈ ਇੰਡੀਆ ਵਿੱਚ ਜਿਹੜਾ ਇੰਨਾਂ ਜ਼ਿਆਦਾ ਅਤੇ ਇੰਡੀਆ ਦੀ ਤਰੱਕੀ ਵਿੱਚ ਹੱਥ ਨਿਭਾਅ ਰਿਹਾ ਹੈ ਕਿ ਅੱਜ ਸਾਰੇ ਲੋਕ ਅਡਾਨੀ ਦੀ ਤਾਰੀਫ ਕਰਦੇ ਹਨ ਉਸ ਦੀ ਵੀ ਬਹੁਤ ਜ਼ਿਆਦਾ ਕੰਪਨੀਆਂ ਹਨ ਭਾਰਤ ਵਿੱਚ ਜਿਹੜਾ ਸਾਨੂੰ ਸਾਡੇ ਲੋਕਾਂ ਵਾਸਤੇ ਬਹੁਤ ਮਦਦ ਕਰਦੇ ਹਨ ਉਸੇ ਸ ਪਰ ਇੱਕ ਹੋਰ ਬੰਦਾ ਹੈ ਜੋ ਕਿ ਬਹੁਤ ਹੀ ਤਕੜਾ ਅਤੇ ਬਹੁਤ ਹੀ ਜ਼ਿਆਦਾ ਰਿਸਪੈਕਟ ਵਾਲਾ ਬੰਦਾ ਹੈ ਉਹਦਾ ਨਾਂ ਹੈ ਏ ਉਸ ਦਾ ਨਾਂ ਹੈ ਜ ਅਡਾਨੀ ਦਾ ਮੁੰਡਾ ਉਸ ਨੇ ਆਪਣੀ ਕੰਪਨੀ ਦਾ ਇੰਨਾਂ ਵੱਡਾ ਸ਼ੇਅਰ ਲੋਕਾਂ ਵਿੱਚ ਵੇਚ ਦਿੱਤਾ ਹੈ ਤਾਂ ਕਿ ਲੋਕ ਵੀ ਅਮੀਰ ਹੋ ਚੁੱਕੇ ਹੋ ਸਕੇ ਅਤੇ ਨਾਲ ਹੀ ਉਸ ਦੀ ਕੰਪਨੀ ਵੀ ਗਰੋ ਕਰਦੀ ਰਹੇ ਅੱਜ ਉਸ ਦੀ ਕੰਪਨੀ ਇਸੇ ਕਾਰਨ ਇੰਨੀ ਜ਼ਿਆਦਾ ਮਸ਼ਹੂਰ ਹੋ ਚੁੱਕੀ ਹੈ ਕਿ ਉਸਦਾ ਬਾਹਰ ਵੀ ਬੜਾ ਜ਼ਿਆਦਾ ਰੋਲ ਚੱਲ ਰਿਹਾ ਹੈ ਅਤੇ ਨਾਲ ਹੀ ਭਾਰਤ ਵਿੱਚ ਤਾਂ ਉਸ ਦਾ ਰੈਪੂਟੇਸ਼ਨ ਵਧੀ ਹੀ ਜਾ ਰਹੀ ਹੈ ਉਸ ਨੇ ਅੱਜ ਦੇ ਟਾਈਮ ਵਿੱਚ ਇੰਨੇ ਲੋਕਾਂ ਦਾ ਦਿਲ ਜਿੱਤਿਆ ਹੋਇਆ ਹੈ ਅਤੇ ਤਰੱਕੀ ਤਾਂ ਉਸਦੀ ਹੋ ਹੀ ਰਹੀ ਹੈ ਉਸ ਦਾ ਅੱਜ ਔਨਲਾਈਨ ਸਟੀਕ ਢਾਈ ਸੌ ਢਾਈ ਸੌ ਰੁਪਏ ਤੋਂ ਵੀ ਜ਼ਿਆਦਾ ਟੱਪੇ ਦਾ ਹੈ ਕਿਉਂਕਿ ਉਸ ਹਰ ਦਿਨ ਉਸ ਦੇ ਸਟੇਕ ਟੱਪੀ ਹੀ ਜਾ ਰਹੇ ਹੈ ਕਿਉਂਕਿ ਉਹ ਹਰ ਨਾਲ ਹਰ ਦਿਨ ਕੋਈ ਨਾ ਕੋਈ ਨਵੀਂ ਟੈਕਨੋਲੋਜੀ ਭਾਰਤ ਵਿੱਚ ਲਿਆਈ ਹੀ ਜਾ ਰਿਹਾ ਹੈ